ਤੁਹਾਡੇ ਜੀਵਨ ਦਾ ਕੋਈ ਅਜਿਹਾ ਯਾਦਗਾਰ ਪਲ ਦੱਸੋ ਜੋ ਤੁਹਾਨੂੰ ਅੱਗੇ ਵੱਧਣ ਵਿੱਚ ਪ੍ਰੇਰਨਾ ਦਿੰਦਾ ਹੈ

ਅਤੇ ਉਹ ਵਾਲਾ ਸਮਾਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਆਪਣੇ ਨਤੀਜੇ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਅਤੇ ਜਦੋਂ ਮੇਰਾ ਨਤੀਜਾ ਆਇਆ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੇ ਤੋਂ ਜ਼ਿਆਦਾ ਖੁਸ਼ੀ ਮੇਰੇ ਪਰਿਵਾਰ ਨੂੰ ਹੋਈ ਸੀ ਕਿਉਂਕੀ ਉਹਨਾਂ ਨੇ ਮੈਨੂੰ ਦੇਖਿਆ ਸੀ ਮਿਹਨਤ ਕਰਦਿਆਂ ਕਿੱਦਾਂ ਮੈਂ ਦਿਨ ਰਾਤ ਲਗਾ ਕੇ ਮਿਹਨਤ ਕੀਤੀ ਹੈ ਅਤੇ ਜਦੋਂ ਇਹ ਨਤੀਜਾ ਆਇਆ ਤਾਂ ਨਤੀਜੇ ਨੂੰ ਦੇਖ ਕੇ ਸਾਰਾ ਹੀ ਪਰਿਵਾਰ ਅਤੇ ਮੈਂ ਬਹੁਤ ਖੁਸ਼ ਸੀ ਅਤੇ ਉੱਥੋਂ ਲੈ ਉਹੀ ਦਿਨ ਉਹੀ ਮਿਹਨਤ ਮੈਂ ਅੱਗੇ ਵੀ ਜਾਰੀ ਰੱਖੀ ਆਪਣੇ ਜੀਵਨ ਦੇ ਵਿੱਚ ਅਤੇ ਉਹਦੇ ਸਦਕਾ ਹੀ ਅੱਜ ਮੈਂ ਇੱਕ ਅਧਿਆਪਕ ਦੇ ਰੂਪ ਵਿੱਚ ਆਪਣੇ ਦੇਸ਼ ਦੀ ਸੇਵਾ ਕਰ ਰਹੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮ ਇੱਕ ਮਿਹਨਤ ਅਤੇ ਇੱਕ ਸਾਡੀ ਸੋਚਣ ਸ਼ਕਤੀ ਹੀ ਹੈ ਜੋ ਸਾਨੂੰ ਹਮੇਸ਼ਾ ਅੱਗੇ ਤੁਰਨ ਦੇ ਲਈ ਪ੍ਰੇਰਿਤ ਕਰਦੀ ਹੈ